ਮੈਂ ਜ਼ਿਆਦਾਤਰ ਰੰਗ ਫਿਲਮੀ ਸਿਤਾਰਿਆਂ ਦੇ ਕੱਪੜਿਆਂ ਨੂੰ ਦੇਖਕੇ ਹੀ ਬਣਾਉਂਦੀ ਹਾਂ ਕਿਉਂਕਿ ਉਹਨਾਂ ਦੀ ਪਸੰਦ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਹੈ ਬਜ਼ਾਰ ਵਿੱਚ ਵੀ ਬਹੁਤ ਸੋਹਣੇ ਰੰਗ ਦੇ ਸੂਟ ਅਤੇ ਚੁੰਨੀਆਂ ਮਿਲਦੀਆਂ ਹਨ ਜਿਹਨਾਂ ਦੇ ਰੰਗ ਬਹੁਤ ਹੀ ਜ਼ਿਆਦਾ ਵੱਖਰੇ ਹੁੰਦੇ ਹਨ ਮੇਰੇ ਮੈਨੂੰ ਗੁਲਾਬੀ ਪੀਲਾ ਰੰਗ ਬਹੁਤ ਹੀ ਜ਼ਿਆਦਾ ਪਸੰਦ ਹੈ ਇਸ ਤੋਂ ਇਲਾਵਾ ਮੈਨੂੰ ਸਫ਼ੇਦ ਰੰਗ ਵੀ ਬਹੁਤ ਹੀ ਜ਼ਿਆਦਾ ਪਸੰਦ ਹੈ ਕਿਉਂਕਿ ਇਹ ਰੰਗ ਸ਼ਾਤੀ ਦਾ ਪ੍ਰਤੀਕ ਹੈ ਮੈਂ ਕੁਦਰਤੀ ਰੰਗਾਂ ਨੂੰ ਦੇਖ ਕੇ ਵੀ ਰੰਗ ਬਣਾਉਂਦੀ ਹਾਂ ਇਹ ਰੰਗ ਪਾਏ ਹੋਏ ਬਹੁਤ ਹੀ ਜ਼ਿਆਦਾ ਸੋਹਣੇ ਲੱਗਦੇ ਹਨ